ਯੋਗਾ ਨੇ ਸਾਡੀ ਨੀਂਦ ਦੇ ਪੈਟਰਨ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ ਹੈ ਯੋਗਾ ਇੱਕ ਪ੍ਰਾਚੀਨ ਵਿਗਿਆਨਿਕ ਵਿਧੀ ਜੋ ਸਾਡੇ ਸਰੀਰ ਮਨ ਅਤੇ ਆਤਮਾ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦੀ ਹੈ ਇਹ ਨੀਂਦ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਦੋਂ ਅਸੀਂ ਨਿਤਨੇਮ ਜਾਂ ਪ੍ਰਾਣਾਯਾਮ ਧਿਆਨ ਅਤੇ ਹਲਕੀਆਂ ਯੋਗ ਆਸਣਾਂ ਦਾ ਅਭਿਆਸ ਕਰਦੇ ਹਾਂ ਤਾਂ ਇਹ ਸਾਡੇ ਮਨ ਨੂੰ ਸ਼ਾਂਤ ਕਰਦੇ ਹਨ ਤਣਾਅ ਘਟਾਉਂਦੇ ਹਨ ਅਤੇ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਦੇ ਹਨ ਖਾਸ ਕਰਕੇ ਸਾਹ ਪ੍ਰਯੋਗ ਜਿਵੇਂ ਨਲੂਮ ਵਿਲੋਮ ਤੇ ਸਵਾਸ ਨਿਯੰਤਰਣ ਤਕਨੀਕਾਂ ਜਿਵੇਂ ਕਿ ਭ੍ਰਾਮਰੀ ਪ੍ਰਣਾਯਾਮ ਮਨ ਨੂੰ ਸ਼ਾਂਤ ਕਰਦਾ ਹੈ ਚਿੰਤਾਵਾਂ ਨੂੰ ਘਟਾਉਂਦਾ ਤੇ ਸਰੀਰ ਨੂੰ ਆਰਾਮ ਦੇਣ ਵਿੱਚ ਬਹੁਤ ਲਾਭਕਾਰੀ ਹੁੰਦਾ ਹੈ ਯੋਗ ਨਿੰਦਰਾ ਇਕ ਹੋਰ ਵਿਧੀ ਹੈ ਜੋ ਗਹਿਰੀ ਨੀਂਦ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ ਇਸ ਦੇ ਨਾਲ ਹਲਕੀਆਂ ਸਰੀਰਕ ਕਸਰਤਾਂ ਜਿਵੇਂ ਕਿ ਵਰਿਕਸ਼ ਆਸਨ ਬਾਲ ਆਸਨ ਸਿਵਾਸਨ ਨਵੀਕਲਾਤਾ ਵਧਾਉਂਦੀਆਂ ਹਨ ਜੋ ਸਾਡੀ ਨੀਂਦ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੀਆਂ ਹਨ ਸਾਡੀਆਂ ਨੂੰ ਨੀਂਦ ਵਧੀਆ ਆਉਣ ਵਿੱਚ ਸਹਾਇਤਾ ਕਰਦੀਆਂ ਜੇਕਰ ਕਿਸੇ ਵਿਅਕਤੀ ਨੂੰ ਨੀਂਦ ਦੀ ਕਮੀ ਹੈ ਜਾਂ ਅਨਿੰਦਰਾ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਨੂੰ ਹਰ ਰੋਜ਼ ਸੌਣ ਵੇਲੇ ਪੰਦਰਾਂ ਵੀਹ ਮਿੰਟ ਯੋਗਾ ਅਭਿਆਸ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਨਿਯਮਿਤ ਰੂਪ ਵਿੱਚ ਧਿਆਨ ਕਰਨ ਨਾਲ ਵੀ ਸਰੀਰ ਵਿੱਚ ਮੈਟਾਬੋਲਿਜਮ ਮੈਲਾ ਟੋਨਿਨ ਹਾਰਮੋਨ ਦੀ ਉਤਪਤੀ ਵਧਦੀ ਹੈ ਜੋ ਨੀਂਦ ਲਈ ਲਾਭਕਾਰੀ ਹੁੰਦਾ ਹੈ ਇਸ ਤਰਾਂ ਯੋਗਾ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ ਬਲਕਿ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਵੀ ਬਹੁਤ ਮਹੱਤਵਪੂਰਨ ਹੈ